ਮੈਂ ਆਪਣੇ ਸਕੂਲ ਟਾਈਮ ਤੋਂ ਹੀ ਬਹੁਤ ਸਾਰੀਆਂ ਡਰਾਇੰਗਾਂ ਬਣਾਈਆਂ ਹਨ ਜਿਹਦੇ 'ਤੇ ਮੈਨੂੰ ਮਾਣ ਹੈ ਮੈਂ ਇੱਕ ਆਰਟਿਸਟ ਵੀ ਹਾਂ ਮੇਰੇ ਮਾਪੇ ਮੇਰੇ ਦੋਸਤ ਮੇਰੇ ਆਲੇ ਦੁਆਲੇ ਵਾਲੇ ਗੁਆਂਢੀ ਸਾਰੇ ਮੈਨੂੰ ਬਹੁਤ ਸਰਹਾਉਂਦੇ ਹਨ ਮੇਰੀ ਪੇਂਟਿੰਗ ਮੇਰੀ ਡਰਾਇੰਗ ਹਰ ਇੱਕ ਚੀਜ਼ ਨੂੰ ਸਰਹਾਉਂਦੇ ਹਨ ਮੈਂ ਪਲਸ ਟੂ ਵਿੱਚ ਫਾਈਨ ਆਰਟਸ ਰੱਖੀ ਸੀ ਜਿਹਦੇ ਵਿੱਚ ਮੈਨੂੰ ਬਹੁਤ ਕੁਛ ਸਿਖਾਇਆ ਗਿਆ ਹੈ ਮੈਨੂੰ ਯਾਦ ਹੈ ਆਖਰੀ ਮਹੀਨੇ ਇੱਕ ਪ੍ਰੋਗਰਾਮ ਦੇ ਉੱਪਰ ਮੈਂ ਇੱਕ ਬਹੁਤ ਵਿਸ਼ਾਲ ਡਰਾਇੰਗ ਬਣਾਈ ਸੀ ਜਿਹਦੇ 'ਤੇ ਲੋਕਾਂ ਨੇ ਮੈਨੂੰ ਬਹੁਤ ਸਹਾਰ ਸਰ ਸਰਹਾਇਆ ਅਤੇ ਬਹੁਤ ਚੰਗਾ ਫੀਡਬੈਕ ਦਿੱਤਾ ਅਤੇ ਮੈਂ ਬਹੁਤ ਹੀ ਚੰਗੇ ਫੀਡਬੈਕ ਨਾਲ ਜਦੋਂ ਘਰ ਆਈ ਤਾਂ ਮੇਰੇ ਮਾਪਿਆਂ ਨੇ ਵੀ ਮੈਨੂੰ ਬਹੁਤ ਸਰਹਾਇਆ ਕਿਉਂਕਿ ਉਸ ਪੇਂਟਿੰਗ ਦੇ ਵਿੱਚ ਮੈਂ ਆਪਣੇ ਗੁਰੂਆਂ ਦੇ ਬਾਰੇ ਡਰੋ ਕੀਤਾ ਸੀ ਅਤੇ ਉਹ ਬਹੁਤ ਹੀ ਇੱਕ ਵਿਸ਼ਾਲ ਚਰਿਤਰਕਾਰੀ ਬਣੀ ਸੀ ਬਹੁਤ ਹੀ ਦੇਖਣ ਨੂੰ ਸੁੰਦਰ ਸੀ ਮੈਨੂੰ ਅੱਜ ਵੀ ਯਾਦ ਹੈ ਅਤੇ ਅੱਜ ਵੀ ਉਹ ਮੇਰੇ ਘਰ ਦੇ ਵਿੱਚ ਮੈਂ ਫਰੇਮ ਕਰਾ ਕੇ ਰੱਖੀ ਹੋਈ ਹੈ ਕਿਉਂਕਿ ਉਹ ਮੇਰੀ ਜ਼ਿੰਦਗੀ ਦੀ ਪਹਿਲੀ ਪ੍ਰਾਪਤੀ ਸੀ ਜਿਹਦੇ ਵਿੱਚ ਮੈਂ ਬਹੁਤ ਹੀ ਚੰਗਾ ਇੱਕ ਇਨਾਮ ਪ੍ਰਾਪਤ ਕੀਤਾ ਸੀ